ਹੈਲੋ ਹਾਂਜੀ ਵਧੀਆ ਤੁਸੀਂ ਸੁਣਾਓ ਕਿੱਦਾਂ ਉਹ ਅੱਜ ਕੁਛ ਵੀ ਨਹੀਂ ਅੱਜ ਸਾਡੇ ਇੱਥੇ ਪੰਜਾਬੀ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਅੱਜ ਉੱਥੇ ਗਈਆਂ ਹਾਂ ਆਪਾਂ ਸਾਰੇ ਹਾਂਜੀ ਅਤੇ ਤੁਹਾਡਾ ਫੇਵਰਟ ਸੀਗਾ ਤੁਹਾਡਾ ਫੇਵਰਟ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਅਤੇ ਕਰੀਨਾ ਕਪੂਰ ਦੀ ਸੀਗੀ ਹਾਂ ਉਡਦਾ ਪੰਜਾਬ ਆ ਲਾਗੇ ਹੀ ਹੈਗਾ ਵੀ ਪੈਦਲ ਡਿਸਟੈਂਸ 'ਚ ਏ ਸੀਗਾ ਆਹ ਕਹਿੰਦੇ ਇਹਨੂੰ ਆਹ ਹਸਪਤਾਲ ਨੀ ਹੈਗਾ ਸਾਡਾ ਸਿਵਲ ਹਸਪਤਾਲ ਉੱਥੇ ਸੀਗੀ ਆਹੋ ਉੱਥੇ ਸੀਗੀ ਸ਼ੂਟਿੰਗ ਬੜੀ ਵਧੀਆ ਹੀ ਬੜੀ ਭੀੜ ਹੂੰ ਪੰਜਾਬੀ ਮੂਵੀ 'ਚ ਆਈ ਕਰੀਨਾ ਉੜਦਾ ਪੰਜਾਬ ਆ ਕੋਈ ਅਸਾਡੇ ਜਿਵੇਂ ਦੇ ਡਰੈਸ ਡਰੁੱਸ ਦਾ ਥੋੜ੍ਹਾ ਜਿਹਾ ਹੁੰਦਾ ਉਹਨਾਂ ਲੋਕਾਂ 'ਚ ਉਹਨਾਂ ਦੇ ਬੇਸ 'ਤੇ ਹੀ ਹੈ ਬੜੀ ਵਧੀਆ ਮੂਵੀ ਹੂੰ ਦਿਲਜੀਤ ਤਾਂ ਸਕਰੀਨ 'ਤੇ ਤਾਂ ਸਹੀ ਲੱਗਦਾ ਲੱਗਦਾ ਉੱਦਾਂ ਦੇਖਣ ਨੂੰ ਵੀ ਬੜਾ ਸਹੀ ਹੈ ਹਾਂ ਕਰੀਨਾ ਵੀ ਉਹ ਦੂਰ ਬੜੀ ਸੀ ਉਹ ਦੂਰ ਬੜੀ ਸੀ ਨਾ ਸਾਡੇ ਥੋੜ੍ਹਾ ਡਿਸਟੈਂਸ ਸੀਗਾ ਤਾਂ ਕਰਕੇ ਹੂੰ ਦੂਰੋਂ ਦੂਰੋਂ ਹਾਂਜੀ ਹਾਂਜੀ ਉੱਦਾਂ ਦਾ ਹੀ ਕਰੀਨਾ ਵੀ ਦੇਖੀ ਅਸੀਂ ਦਿਲਜੀਤ ਵੀ ਦੇਖਿਆ ਵਧੀਆ ਬੜੀ ਵਧੀਆ ਸ਼ੂਟਿੰਗ ਹੋਈ ਹਾਂ ਹਾਂਜੀ ਪਰ ਕਾਫ਼ੀ ਟਾਈਮ ਹੋ ਗਿਆ ਸੀ ਅਤੇ ਫਿਰ ਅਸੀਂ ਵਾਪਸ ਆ ਗਏ ਨਹੀਂ ਤਾਂ ਤੁਹਾਨੂੰ ਲੈ ਹੀ ਜਾਂਦੇ ਨਹੀਂ ਸਾਨੂੰ ਇੰਨਾ ਹੀ ਤੇ ਅਸੀਂ ਅੱਜ ਸਾਨੂੰ ਪਤਾ ਲੱਗਾ ਸੀ ਅਤੇ ਅੱਜ ਚਲਗੀਆਂ ਤਾਂ ਪੈਕਅਪ ਹੋ ਗਿਆ ਹੋਇਆ ਵਾ ਚਲੋ ਕੋਈ ਨਹੀਂ ਫਿਰ ਹੋਵੇਗੀ ਤਾਂ ਫਿਰ ਤੁਹਾਨੂੰ ਦੱਸਾਂਗੇ ਹਾਂਜੀ ਹਾਂਜੀ ਹਾਂ ਮੈਂ ਜ਼ਰੂਰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਓਕੇ ਜੀ ਹਾਂਜੀ ਹਾਂਜੀ ਓਕੇ ਜੀ ਬਾਏ ਬਾਏ ਜੀ